ਤੁਸੀਂ ਜੈਨ ਇਲੈਕਟਰੋਨਿਕ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਹੈੱਡਫੋਨ ਖਰੀਦਿਆ ਸੀ ਜੋ ਕਿ ਬਹੁਤ ਵਧੀਆ ਕੁਆਲਿਟੀ ਦਾ ਹੈ ਉਹ ਉਸਦੇ ਵਾਇਰ ਵੀ ਬਹੁਤ ਵਧੀਆ ਹੈ ਅਤੇ ਸਾਊਂਡ ਵੀ ਉਸ ਵਿੱਚ ਬਹੁਤ ਵਧੀਆ ਹੈ ਅਤੇ ਉਹ ਮੈਂ ਰੋਜ਼ਾਨਾ ਰਾਤ ਨੂੰ ਸੌਣ ਵੇਲੇ ਕੰਨਾਂ 'ਚ ਲਾਉਂਦੀ ਹਾਂ ਅਤੇ ਉਹਦੀ ਸਾਊਂਡ ਵੀ ਬਹੁਤ ਵਧੀਆ ਅਵਾਜ਼ ਹੈਗੀ ਆ ਆਵਾਜ਼ ਵੀ ਬਹੁਤ ਵਧੀਆ ਉਹਦੀ ਅਤੇ ਉਹ ਟੁੱਟਦੇ ਵੀ ਨਹੀਂ ਛੇਤੀ ਅਤੇ ਉਹ ਵਧੀਆ ਕੁਆਲਿਟੀ ਦੇ ਹਨ ਉਹ ਰੇਟ ਵੀ ਬਹੁਤ ਘੱਟ ਹੈ ਅਤੇ ਆਪਦੇ ਮੈਂ ਦੋਸਤਾਂ ਨੂੰ ਸਲਾਹ ਦਊਗੀ ਇਹੀ ਸਲਾਹ ਦਊਗੀ ਕਿ ਇਹ ਤੁਹਾਡੇ ਤੋਂ ਤੁਹਾਡੀ ਇਲੈਕਟਰੋਨਿਕ ਤੋਂ ਇਹ ਹੈੱਡਫੋਨ ਖਰੀਦਣ ਵ ਜੋ ਕਿ ਬਹੁਤ ਵਧੀਆ ਕੁਆਲਿਟੀ ਦੇ ਹਨ ਧੰਨਵਾਦ ਬਹੁਤ ਬਹੁਤ ਤੁਹਾਡਾ